ਮੇਰੇ ਘਰ ਦੇ ਆਸ ਪਾਸ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਮਿਲਾ ਕੇ ਤਕਰੀਬਨ ਅੱਠ ਤੋਂ ਦਸ ਹਸਪਤਾਲ ਹਨ ਇਹਨਾਂ ਵਿੱਚ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ ਮੇਰੇ ਘਰ ਦੇ ਸਭ ਤੋਂ ਨੇੜੇ ਗੋਬਿੰਦ ਹਸਪਤਾਲ ਹੈ ਅਤੇ ਥੋੜ੍ਹੀ ਦੂਰ ਅਮਰ ਹਸਪਤਾਲ ਰਜਿੰਦਰਾ ਹਸਪਤਾਲ ਅਤੇ ਕਲੰਬੀਆ ਏਸ਼ੀਆ ਵਰਗੇ ਵੱਡੇ ਹਸਪਤਾਲ ਹਨ ਮੈਨੂੰ ਇਹਨਾਂ ਵਿੱਚ ਪਹੁੰਚਣ ਲਈ ਕੋਈ ਤਕਲੀਫ ਨਹੀਂ ਹੁੰਦੀ